ਅੱਜ ਕੱਲ੍ਹ ਦੁਨੀਆਂ ਵਿੱਚ ਵਹਿਮ ਭਰਮ ਬਹੁਤ ਫੈਲ ਗਏ ਹਨ ਸਾਡੇ ਮੋਹਾਲੀ ਇਲਾਕੇ ਵਿੱਚ ਚਾਰ ਤਰ੍ਹਾਂ ਦੇ ਵਹਿਮ ਭਰਮ ਬਹੁਤ ਹੀ ਜਿਆਦਾ ਪ੍ਰਚਲਿੱਤ ਹਨ ਜੋ ਵੀ ਪੂਰੇ ਐਨ ਜੋਰਾਂ ਸ਼ੋਰਾ 'ਤੇ ਹੈ ਇੱਕ ਤਾਂ ਹੈ ਜਦੋਂ ਚੱਪਲ ਪੁੱਠੀ ਹੋ ਜਾਂਦੀ ਹੈ ਲੋਕਾਂ ਨੂੰ ਡਰ ਹੁੰਦਾ ਹੈ ਕਿ ਸਾਡੇ ਛਿੱਤਰ ਪੈਣਗੇ ਚੱਪਲ ਪੁੱਠੀ ਹੋਣ ਨਾਲ਼ ਅਤੇ ਦੂਜਾ ਕੋਈ ਕੰਚ ਟੁੱਟ ਜਾਵੇ ਹੈ ਉਹ ਉਹਨਾਂ ਨੂੰ ਲੋਕ ਕਈ ਲੋਕ ਮੰਨਦੇ ਹਨ ਵੀ ਉਹ ਸ਼ੁੱਭ ਹੁੰਦਾ ਹੈ ਅਤੇ ਕਈ ਲੋਕ ਮੰਨਦੇ ਹਨ ਉਹ ਅਸ਼ੁੱਭ ਹੁੰਦਾ ਹੈ ਚਲੋ ਆਪਣੇ ਆਪਣੀ ਹੈ ਅਤੇ ਲੋਕਾਂ ਨੂੰ ਇੱਕ ਹੋਰ ਬਹੁਤ ਵੱਡਾ ਵਹਿਮ ਭਰਮ ਹੈ ਹੈਗਾ ਇਹ ਜਿਹੜਾ ਕੀ ਹੈ ਸਾਡੇ 'ਤੇ ਕੁਛ ਕਿਸੀ ਨੇ ਕੁਝ ਕਰਵਾ ਦਿੱਤਾ ਜਿਵੇਂ ਕਿ ਟੂਣਾ ਮਾਣਾ ਅੱਜ ਕੱਲ੍ਹ ਲੋਕਾਂ ਜੇ ਕਿਸੀ ਦਾ ਸਰੀਰ ਦੁੱਖਦਾ ਹੈ ਜਾਂ ਕਿਸੀ ਦਾ ਕੰਮ ਨਹੀਂ ਬਣਦਾ ਹੈ ਚਲੋ ਅਗਲੇ ਦੇ ਕਰਮਾਂ ਦੀ ਉਹਨਾਂ ਦੀ ਰੋਟੀ ਹੈ ਪਰ ਅੱਜ ਕੱਲ੍ਹ ਲੋਕ ਬਹੁਤ ਜਿਆਦਾ ਚਲੋ ਮੰਨਿਆ ਵੀ ਲੋਕ ਇੱਕ ਦੂਜੇ ਦੇ ਵੈਰੀ ਬਣੇ ਹੋਏ ਹਨ ਪਰ ਲੋਕਾਂ ਨੂੰ ਇਹੀ ਵਹਿਮ ਰਹਿ ਜਾਂਦਾ ਹੈ ਉਹ ਇਹੀ ਸੋਚੀ ਜਾਂਦੇ ਵੀ ਸਾਡੇ 'ਤੇ ਕੁਛ ਕਿਸੀ ਨੇ ਕੁਝ ਕਰਵਾਇਆ ਹੈ ਟੂਣਾ ਮਾਣਾ ਇਸ ਲਈ ਉਹਨਾਂ ਦੇ ਕੰਮ ਨਹੀਂ ਬਣਦੇ ਹਨ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਹੈ ਚਲੋ ਇਹ ਇਹਨਾਂ ਚੀਜ਼ਾਂ ਦੇ ਲੋਕ ਬਹੁਤ ਹੀ ਜਿਆਦਾ ਮਜਬੂਤੀ ਨਾਲ਼ ਵਿਸ਼ਵਾਸ ਕਰਦੇ ਹਨ ਅਤੇ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਅਤੇ ਇਹ ਇਹ ਤਿੰਨ ਚਾਰ ਵਹਿਮ ਭਰਮ ਹੈ ਅਤੇ ਬਹੁਤ ਹੀ ਜਿਆਦਾ ਚੱਲੇ ਹੋਏ ਹਨ ਪ੍ਰਚਲਿੱਤ ਹਨ ਜਿਹੜੇ ਕਿ ਲੋਕ ਬਹੁਤ ਹੀ ਜਿਆਦਾ ਮੰਨਦੇ ਹਨ